ਹਾਂਜੀ ਗੱਲ ਕਰੀਏ ਲੋਕਡਾਊਨ ਦੀ ਤਾਂ ਲੋਕਡਾਊਨ ਦੋ ਹਜ਼ਾਰ ਵੀਹ ਤੋਂ ਸ਼ੁਰੂ ਹੋਇਆ ਸੀਗਾ ਜਿਹਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਲੋਕਡਾਊਨ ਦੇ ਵਿੱਚ ਕਾਫ਼ੀ ਕੁਝ ਘਰ ਵਿੱਚ ਬਣਾਇਆ ਜਿਹਦੇ ਵਿੱਚ ਨਿਊਡਲ ਹੋ ਗਏ ਮੱਠੀਆਂ ਹੋ ਗਈਆ ਗੁਲਗੁਲੇ ਹੋ ਗਏ ਹੋਰ ਸੇਮੀਆਂ ਹੋ ਗਈਆਂ ਅਤੇ ਉਸ ਦੌਰਾਨ ਮ ਮੈਂ ਘਰ ਦੇ ਵਿੱਚ ਟਰਾਈ ਕੀਤਾ ਜੋ ਉਹ ਸੀ ਪਕੌੜੇ ਜੋ ਕਿ ਤੰਦੂਰੀ ਪਕੌੜੇ ਹੁੰਦੇ ਆ ਪਨੀਰ ਦੇ ਅਤੇ ਉਹਦੇ ਵਿੱਚ ਪਨੀਰ ਨੂੰ ਛੋ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਉਸ ਦੇ ਵਿੱਚ ਇੱਕ ਲੋਹੇ ਦੀ ਲੋਹੇ ਦੀ ਇਕ ਤੱਕ ਤੱਕਲੇ ਵਰ ਵਰਗੀ ਸੂਈ ਲੈ ਲੈਂਦੇ ਹਾਂ ਜਿਹਦੇ ਵਿੱਚ ਕਿ ਸ਼ਿਮਲਾ ਮਿਰਚ ਹੋ ਗਈ ਪਿਆਜ ਨੂੰ ਕੱਟ ਕੇ ਪਾਇਆ ਜਾਂਦਾ ਗਾ ਸ਼ਿਮਲਾ ਮਿਰਚ ਨੂੰ ਕੱਚ ਕੱਟ ਕੇ ਪਾਇਆ ਜਾਂਦਾ ਗਾ ਅਤੇ ਪਨੀਰ ਦੇ ਥੋੜ੍ਹੇ ਜਿਹੇ ਵੱਡੇ ਟੁਕੜਿਆਂ ਨੂੰ ਕੱਟ ਕੇ ਪਾਇਆ ਜਾਂਦਾ ਗਾ ਅਤੇ ਉਸ ਦੇ ਉੱਪਰ ਦੇਸੀ ਘਿਓ ਵੀ ਲਗਾ ਸਕਦੇ ਹਾਂ ਮਿਰਚ ਮਸਾਲਾ ਲਗਾ ਕੇ ਉਸ ਨੂੰ ਤੰਦੂਰ ਦੇ ਵਿੱਚ ਪਕਾਉਣ ਵਾਸਤੇ ਰੱਖਿਆ ਜਾਂਦਾ ਹੈਗਾ ਅਤੇ ਉਸ ਉੱਪਰ ਉਸ ਉੱਪਰ ਆਪਣੇ ਸਵਾਦ ਮੁਤਾਬਿਕ ਜੋ ਕੁਛ ਵੀ ਲਗਾ ਸਕਦੇ ਹਾਂ ਆਪਾਂ ਜਿਵੇਂ ਕਈ ਸੋਸ ਵੀ ਲਗਾ ਲੈਂਦੇ ਹਨ ਉਸ ਉਸ ਉੱਪਰ ਅਤੇ ਪਰ ਉਹ ਮੈਨੂੰ ਬਹੁਤ ਪਸੰਦ ਆ ਅਤੇ ਬਹੁਤ ਹੀ ਵਧੀਆ ਚੀਜ਼ ਆ ਉਹ ਅਤੇ ਮੈਂ ਮੈਨੂੰ ਉਹ ਕਾਫ਼ੀ ਪਸੰਦ ਆ